ਹੈਲੋ ਪਿੰਡਾਂ ਵਾਲੇ ਹਸਪਤਾਲ 'ਚੋ ਬੋਲਦੇ ਮਾਨਸਾ ਤੋਂ ਬੋਲ ਰਹੇ ਹੋ ਮਾਨਸਾ ਤੋਂ ਗੱਲ ਕਰਦੇ ਹੋ ਅਸੀਂ ਬੁਢਲਾਢਾ ਤੋਂ ਬੋਲਦੇ ਸੀ ਮੈਂ ਦੰਦ ਚੈਕ ਕਰਵਾਉਣੇ ਸੀ ਮੇਰੇ ਦੰਦ ਜੀ ਬਹੁਤ ਦਰਦ ਕਰਦੇ ਆ ਨਾ ਜੀ ਭਾਅ ਜੀ ਪਹਿਲਾਂ ਦੋ ਵਾਰ ਦਿਖਾ ਚੁੱਕੇ ਆ ਫੀਸ ਕਿੰਨੀ ਹੈ ਜੀ ਤੁਹਾਡੀ ਅਤੇ ਜਿਹੜੀ ਦਵਾਈ ਲਿਖਦੇ ਹੋ ਮਹਿੰਗੀ ਤਾਂ ਨਹੀਂ ਹੈਗੀ ਜੀ ਕੋਈ ਨੁਕਸਾਨ ਤਾਂ ਨਹੀਂ ਹੈਗਾ ਜੀ ਮੇਰੇ ਦੰਦ ਠੀਕ ਹੋ ਜਾਣਗੇ ਜੀ ਕਢਵਾਉਣੇ ਤਾਂ ਨਹੀਂ ਪੈਣੇ ਜੀ ਕਢਵਾਉਂਣੇ ਤਾਂ ਨਹੀਂ ਪੈਣੇ ਪਹਿਲਾਂ ਵੀ ਜੀ ਮੈਂ ਬਹੁਤ ਡਾਕਟਰਾਂ ਨੂੰ ਦਿਖਾ ਚੁੱਕਿਆ ਜੀ ਮੈਨੂੰ ਮੇਰੇ ਦੋਸਤ ਨੇ ਦੱਸਿਆ ਸੀ ਤੁਹਾਡੇ ਬਾਰੇ ਕਹਿੰਦੇ ਜੀ ਡਾਕਟਰ ਬਹੁਤ ਵਧੀਆ ਜੀ ਮਾਨਸਾ ਹਾਂਜੀ ਉਹ ਤੁਹਾਡੇ ਤੋਂ ਲੈਂਦੇ ਦਵਾਈਆਂ ਜੀ ਬਾਕੀ ਹੋਰ ਵੀ ਪੇਸ਼ੈਂਟ ਆਉਂਦੇ ਤੁਹਾਡੇ ਲਵੇ ਜੀ ਪਹਿਲਾਂ ਇਲਾਜ ਕੀਤਾ ਜੀ ਥੋਨੇ ਕਿਸੇ ਦਾ ਅੱਛਾ ਜੀ ਸਵੇਰੇ ਕਿੰਨੇ ਵਜੇ ਖੁੱਲ੍ਹ ਜਾਂਦਾ ਜੀ ਕੋਈ ਗੱਲ ਨਹੀਂ ਮੈਂ ਨੌ ਦਸ ਵਜੇ ਤੱਕ ਆ ਜਾਊਂਗਾ ਜੀ ਕੋਈ ਗੱਲ ਨਹੀਂ ਸਰ ਮੈਂ ਕੱਲ੍ਹ ਆ ਜਾਊਂਗਾ ਜੀ ਓਕੇ ਧੰਨਵਾਦ